ਹਾਂਜੀ ਕਿਵੇਂ ਓ ਹੋਰ ਘਰੇ ਸਾਰੇ ਠੀਕ ਨੇ ਹਾਂਜੀ ਹਾਂਜੀ ਵਧੀਆ ਓਹ ਫਿਰ ਤੁਹਾਨੂੰ ਇਸ ਕਰਕੇ ਫੋਨ ਲਾਇਆ ਸੀ ਮੈਂ ਗੁੜ ਬਾਰੇ ਪੁੱਛਦੀ ਸੀ ਤੁਹਾਡੇ ਤੋਂ ਹਾਂਜੀ ਹਾਂਜੀ ਵੀ ਜਿਵੇਂ ਸਰਦੀਆਂ ਵਿੱਚ ਆਪਾਂ ਗੁੜ ਖਾਨੇ ਆ ਵੀ ਉਹ ਤਾਂ ਕੀ ਫਾਇਦਾ ਆ ਨੁਕਸਾਨ ਹ ਗਰਮੀਆਂ ਚ ਖਾਨੇ ਆ ਉਹਦਾ ਕੀ ਫਾਇਦਾ ਆ ਨੁਕਸਾਨ ਹ

ਹਾਂਜੀ ਹਾਂਜੀ ਨਾਲੇ ਕਹਿੰਦੇ ਆ ਗਰਮੀ 'ਚ ਖਾਣ ਗਰਮੀ ਚ ਗੁੜ ਖਾਣਾ ਨਹੀਂ ਚਾਹੀਦਾ ਵੀ ਨੁਕਸਾਨ ਕਰਦਾ

ਹਾਂਜੀ ਹਾਂਜੀ ਹਾਂਜੀ ਕਰਦੇ ਜਿਦਾਂ ਆਪਾਂ ਮਤਲਬ ਚਾਹ ਚ ਪਾ ਕੇ ਪੀ ਸਕਦੇ ਆਗੇ ਜੇ ਸ਼ਹਿਦ ਵਗੈਰਾ ਚ ਪਾ ਕੇ ਨਾ ਹਾਂਜੀ ਹਾਂਜੀ ਠੀਕ ਐ ਤੇ ਇਹ ਦਾ ਨੁਕਸਾਨ ਕੀ ਆ ਮਤਲਬ ਆਹੀ ਚੀਜ਼ ਨੂੰ ਗਰਮ ਕਰਕੇ ਹਾਂਜੀ ਹਾਂਜੀ ਠੀਕ ਐ ਜੀ ਹੋਰ ਮਤਲਬ ਗੁੜ ਦਾ ਹੋਰ ਕੋਈ ਫਾਇਦਾ ਵਗੈਰਾ ਅੱਜ ਕੱਲ ਅੱਜ ਕੱਲ ਸੁਣਿਆ ਵੀ ਗੁੜ ਵਿੱਚ ਕੈਮੀਕਲ ਜਿਆਦਾ ਆਉਂਦਾ ਗਾ ਵੀ ਆਪਾਂ ਨੂੰ ਕਿਹੜਾ ਗੁੜ ਖਾਣਾ ਚਾਹੀਦਾ ਹਾਂਜੀ

ਹਾਂਜੀ ਹਾਜੀ ਮਤਲਵ ਕਲਾੜੇ ਆਲਾ ਗੁੜ ਕਹਿੰਦੇ ਆਗੇ ਹਾਂਜੀ ਉਹ ਤਾਂ ਜਿਆਦਾ ਸੇਵਨ ਕਰਨਾ ਚਾਹੀਦਾ ਰੋਟੀ ਤੋਂ ਬਾਅਦ ਕਹਿੰਦੇ ਨਾਲੇ ਖਾਣਾ ਚਾਹੀਦਾ ਚੰਗਾ ਹੁੰਦਾ ਠੀਕ ਹੈ ਜੀ ਬਸ ਮੈਂ ਆਹੀ ਪੁੱਛਦੀ ਸੀਗੀ ਠੀਕ ਆ